ਅੱਗੇ ਭਵਿੱਖ ਵਿੱਚ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਬਹੁਤ ਹੀ ਜ਼ਿਆਦਾ ਮੁਹਿੰਮਾਂ ਚੱਲ ਰਹੀਆਂ ਹਨ ਪੰਜਾਬੀ ਬਚਾਓ ਬੱਚਿਆਂ ਨੂੰ ਪੰਜਾਬੀ ਪੜਾਓ ਪੰਜਾਬੀ ਲਿਖਾਓ ਇੱਦਾਂ ਦੀਆਂ ਮੁਹਿੰਮਾਂ ਕਈ ਸੰਸਥਾ ਵੱਲੋਂ ਚਲਾਈਆਂ ਜਾ ਰਹੀਆਂ ਹਨ ਅਤੇ ਸਕੂਲਾਂ ਵਿੱਚ ਵੀ ਜਿਵੇਂ ਹੁਣ ਪ੍ਰਾਈਵੇਟ ਸਕੂਲ ਹੋ ਜਾਂਦੇ ਹਨ ਉਹਨਾਂ ਵਿੱਚ ਵੀ ਪੰਜਾਬੀ ਭਾਸ਼ਾ ਲਾਗੂ ਕਰਨ ਦੇ ਅਪੀਲਾਂ ਲਗਾਤਾਰ ਚੱਲ ਰਹੀਆਂ ਹਨ ਜਿਸ ਨਾਲ਼ ਬੱਚਿਆਂ ਨੂੰ ਅੱਗੇ ਅ ਆਪਣੀ ਮਾਂ ਬੋਲੀ ਭਾਸ਼ਾ ਬਾਰੇ ਪਤਾ ਲੱਗੇਗਾ ਜਿਸ ਨਾਲ਼ ਪੰਜਾਬੀ ਬਚੀ ਰਹੇਗੀ ਸੁਰੱਖਿਅਤ ਰਹੇਗੀ ਅ ਅੱਗੇ ਬੱਚਿਆ ਨੂੰ ਵੀ ਪਤਾ ਲੱਗਦਾ ਰਹੇਗਾ ਵੀ ਸਾਡੀ ਇਹ ਮਾਂ ਬੋਲੀ ਹੈ ਉਹ ਪੰਜਾਬ ਵਿੱਚ ਮਾਂ ਬੋਲੀ ਬੋਲਣਗੇ ਹੋਰ ਭਾਸ਼ਾ ਨੂੰ ਘੱਟ ਉਹ ਦੇ ਕੇ ਪੰਜਾਬੀ ਭਾਸ਼ਾ ਵੱਲ ਜ਼ਿਆਦਾ ਰੁਝੇਵਾ ਕਰਨਗੇ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਸਰਲ ਅਤੇ ਉੱਚ ਭਾਸ਼ਾ ਹੈ ਇਸ ਭਾਸ਼ਾ ਵਿੱਚ ਬਹੁਤ ਹੀ ਜ਼ਿਆਦਾ ਅੱਗੇ ਇਤਿਹਾਸਿਕ ਚੀਜ਼ਾਂ ਲਿਖੀਆਂ ਗਈਆਂ ਹਨ ਜੋ ਕਿ ਅੱਗੇ ਫਾਇਦੇਮੰਦ ਚੀਜ਼ਾਂ ਵੀ ਲਿਖੀਆਂ ਗਈਆਂ ਹਨ ਸਾਡੇ ਬਜ਼ੁਰਗਾਂ ਵੱਲੋਂ ਜਿਸ ਨਾਲ਼ ਅੱਗੇ ਭਵਿੱਖ ਵਿੱਚ ਉਹ ਉਹ ਚੀਜ਼ਾਂ ਵਰਤਣ ਨਾਲ਼ ਬਹੁਤ ਹੀ ਜ਼ਿਆਦਾ ਲਾਭ ਹੋਏਗਾ ਹੁਣ ਅਸੀਂ ਦੇਖਿਆ ਹੈ ਕਿ ਪੰਜਾਬ ਵਿੱਚ ਹਰੇਕ ਜਗ੍ਹਾ ਪੰਜਾਬੀ ਨੂੰ ਬੋਰਡਾਂ ਉੱਤੇ ਪਹਿਲੇ ਨੰਬਰ 'ਤੇ ਲਿਖਿਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਦਾ ਉੱਤਮ ਦਰਜਾ ਹੀ ਰਹਿਣਾ ਚਾਹੀਦਾ ਹੈ ਅਤੇ ਇਸ ਨੂੰ ਹੋਰ ਸੁਰੱਖਿਅਤ ਕਰਨ ਲਈ ਘਰਾਂ ਦੇ ਵਿੱਚ ਨਿਆਣਿਆਂ ਨੂੰ ਜਿਵੇਂ ਹੁਣ ਨਵੇਂ ਲੋਕਾਂ ਨੇੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੈ ਕਈ ਮੁੰਡਿਆਂ ਨੇ ਮਿਲ ਕੇ ਨੌਜਵਾਨਾਂ ਨੇ ਪੰਜਾਬੀ ਕਾਰਟੂਨ ਚਲਾ ਦਿੱਤੇ ਹਨ ਆਪਾਂ ਬੱਚਿਆਂ ਨੂੰ ਕਾਰਟੂਨ ਤਾਂ ਦਿਖਾਉਂਦੇ ਹੀ ਹਨ ਪਰ ਪੰਜਾਬੀ ਕਾਰਟੂਨ ਜੋ ਚਲਾਏ ਹਨ ਉਹ ਵੀ ਦਿਖਾਉਣੇ ਚਾਹੀਦੇ ਹਨ ਜਿਸ ਨਾਲ਼ ਬੱਚਿਆਂ ਨੂੰ ਸਿੱਖਣ ਲਈ ਬਹੁਤ ਹੀ ਜ਼ਿਆਦਾ ਉਤਸ਼ਾਹ ਮਿਲੇਗਾ ਅਤੇ ਉਹ ਵਧੀਆ ਪੰਜਾਬੀ ਸਿੱਖ ਸਕਣਗੇ